ਹੈਲੋ ਵਧੀਆ ਵਧੀਆ ਵੀਰ ਜੀ ਹਾਂਜੀ ਹਾਂਜੀ ਇਹਦਾ ਵੀਰ ਜੀ ਮੁੱਖ ਕਾਰਨ ਹ ਦੇਖੋ ਇੱਕ ਤਾਂ ਪਹਿਲੀ ਗੱਲ ਨਸ਼ਾ ਠੀਕ ਆ ਤੁਹਾਨੂੰ ਜਿਵੇਂ ਪਤਾ ਹੀ ਆ ਅੱਜ ਕੱਲ੍ਹ ਕਿੰਨਾ ਨਸ਼ਾ ਵੱਧ ਚੁੱਕਾ ਜਿੱਥੇ ਮਰਜ਼ੀ ਚਲ ਜਾਓ ਤੁਹਾਨੂੰ ਅਮਲੀ ਮਿਲ ਹੀ ਜਾਣੇ ਹੈ ਨਾ ਅਤੇ ਦੂਜਾ ਕਾਰਨ ਇਹ ਵੀ ਆ ਕਿ ਨੌਕਰੀਆਂ ਨਹੀਂ ਹੈਗੀਆਂ ਇਸ ਕਰਕੇ ਬੱਚੇ ਜਾਈ ਜਾ ਰਹੇ ਬਾਹਰ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਹੀ ਨਾ ਮੈਂ ਮੈਂ ਉਹ ਹੀ ਤੁਹਾਨੂੰ ਦੱਸ ਰਿਹਾ ਕਿ ਸਰਕਾਰਾਂ ਦਾ ਵੀ ਇੱਕ ਅਹਿਮ ਹੱਥ ਹੁੰਦਾ ਇਹਦੇ ਵਿੱਚ ਹੈ ਨਾ ਤੁਸੀਂ ਸਮਝ ਹੀ ਸਕਦੇ ਹੋ ਕਿ ਆਪਾਂ ਪੰਜ ਸਾਲ ਇੱਕ ਸਰਕਾਰ ਨਾਲ ਕੱਢਣੇ ਹੁੰਦੇ ਜਾਂ ਉਹ ਸਰਕਾਰ ਨੇ ਮਤਲਬ ਕੀ ਕਰਨਾ ਹੁੰਦਾ ਉਹ ਜ਼ਿਲ੍ਹੇ ਦਾ ਵਿਕਾਸ ਕਰਨਾ ਹੁਣ ਜਿਵੇਂ ਤੁਸੀਂ ਦੱਸਿਆ ਕਿ ਵੀਹ ਸਾਲ ਹੋ ਗਏ ਇਹਨੂੰ ਰਾ ਜ਼ਿਲ੍ਹਾ ਬਣੇ ਨੂੰ ਹੈ ਨਾ ਅਤੇ ਉਹਦਾ ਤੁਸੀਂ ਦੋਵਾਂ ਵਿਚ ਕੰਟਰੀਆਂ ਜਿਹੜੀਆਂ ਬਾਹਰਲੀਆਂ ਉਹ ਕਿੱਥੇ ਕਾਮਯਾਬੀ ਤੱਕ ਪਹੁੰਚ ਜਾਂਦੀਆਂ ਪਰ ਸਾਡੇ ਜ਼ਿਲ੍ਹੇ ਕਿਉਂ ਨਹੀਂ ਪਹੁੰਚ ਸਕਦੇ ਬਸ ਬਸ ਹਾਂਜੀ ਹਾਂਜੀ ਹਾਂਜੀ ਉਹੀ ਗੱਲ ਨਾ ਵੀਰ ਜੀ ਮੈਂ ਵੀ ਤਾਂ ਉਹੀ ਕਿਹਾ ਤੁਹਾਨੂੰ ਕਿ ਵੇਖੋ ਹੁਣ ਮਾਂ ਪਿਓ ਜਿਵੇਂ ਤੁਸੀਂ ਦੱਸਿਆ ਕਿ ਹੁਣ ਐੱਮ ਏ ਬੀ ਐਡ ਕਰਾ ਕੇ ਬਾਹਰ ਭੇਜਦੇ ਪਏ ਹੈ ਨਾ ਅਤੇ ਉਹ ਤਾਂ ਤਾਂਹੀ ਉਹਨਾਂ ਨੂੰ ਇੱਥੇ ਕੁਛ ਲੱਭਦਾ ਨਹੀਂ ਨਾ ਜੇ ਇੰਨੇ ਹੀ ਇੱਥੇ ਕੁਛ ਇਹਨੂੰ ਫਿਰ ਇੰਨਾ ਪੈਸਾ ਲਾ ਕੇ ਜੇ ਇੱਥੇ ਪੜ੍ਹਾਉਂਦੇ ਅਤੇ ਜੇ ਨੌਕਰੀਆਂ ਵਧੀਆ ਹੋਣ ਅਤੇ ਪੰਜਾਬ ਸਰਕਾਰ ਮਦਦ ਕਰੇ ਕਿਉਂ ਨਹੀਂ ਇੱਥੇ ਬਣ ਸਕਦਾ ਬਾਹਰਲਾ ਦੇਸ਼ ਇੱਥੇ ਹੀ ਬਣ ਸਕਦਾ ਬਸ ਬਸ

ਬਿਲਕੁਲ ਬਿਲਕੁਲ ਬਿਲਕੁਲ ਉਹੀ ਤਾਂ ਹੈਗਾ ਬਈਆ ਬਈਆ ਬਹੁਤ ਜ਼ਿਆਦਾ ਹੈਗੀਆਂ ਹੁਣ ਗੱਲਾਂ ਕਰਨ ਲੱਗੀਏ ਤਾਂ ਫਿਰ ਬਹੁਤ ਜ਼ਿਆਦਾ ਹੋ ਜਾਣੀਆਂ ਅਤੇ ਉਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਕਿ ਜੋ ਵੀ ਇਹ ਬੱਚੇ ਬਾਹਰ ਜਾਂਦੇ ਪਏ ਮਾਂ ਪਿਓ ਪੈਸਾ ਲਾਉਂਦੇ ਪਏ ਪਰ ਉਹੀ ਨਾ ਫਿਰ ਐਂਡ 'ਤੇ ਆ ਕੇ ਗੱਲ ਉੱਥੇ ਹੀ ਮੁੱਕਦੀ ਹੈ ਕਿ ਫਿਰ ਇਸ ਤਰ੍ਹਾਂ ਤਾਂ ਕਦੀ ਵਿਕਾਸ ਤਾਂ ਹੋ ਹੀ ਨਹੀਂ ਸਕਦਾ ਹੈ ਨਾ ਸਹੀ ਗੱਲ ਜੀ ਨਸ਼ੇ ਤਾਂ ਦੇਖੋ ਨਸ਼ਾ ਤਰਨ ਤਾਰਨ ਦੇ ਵਿੱਚ ਨਹੀਂ ਨਸ਼ਾ ਤਾਂ ਪੂਰੇ ਭਾਰਤ ਵਿੱਚ ਹੀ ਬਹੁਤ ਬ ਜ਼ਿਆਦਾ ਫੈਲ ਚੁੱਕਾ ਅਤੇ ਪੰਜਾਬ ਦੇ ਤਾਂ ਨਸ਼ਿਆ ਵਿੱਚ ਬਹੁਤ ਹੀ ਮਾੜੇ ਹਾਲਾਤ ਹੋਏ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਹੁਤ ਵਧੀਆ ਵੀਰ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਨਾਲ ਗੱਲ ਕਰਨ ਵਾਸਤੇ ਵੀਰ ਜੀ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ ਵਧੀਆ ਵਧੀਆ ਵੀਰ ਜੀ